ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਅਮਨ ਅਮਨ ਦੀ ਮੰਮੀ ਗੱਲ ਕਰਦੀ ਪਈ ਹਾਂ ਮੈਮ ਸਕੂਲ ਦੇ ਵਿੱਚ ਸਪੋਟਸ ਮੀਟ ਹੋ ਰਹੀ ਆ ਹਾਂਜੀ ਅਤੇ ਮੈਮ ਇਹਦੇ ਵਿੱਚ ਅਮਨ ਨੂੰ ਨਹੀਂ ਲਿੱਤਾ ਤੁਸੀਂ ਫਿਰ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਮੈਮ ਐਵੇਂ ਮਤਲਬ ਕਿਸੇ ਵੀ ਟਰਾਇਲ ਦੇ ਵਿੱਚ ਨਹੀਂ ਪਾਸ ਹੋਇਆ ਇਹ

ਮੈਡਮ ਉਹ ਤਾਂ ਕਹਿੰਦਾ ਮੈਂ ਪਾਰਟੀਸਪੇਟ ਕਰਨਾ ਮੈਂ ਕਰਨਾ ਹੁਣ ਦੇਖੋ ਮੈਂ ਕੀ ਕਰਾਂ ਉਹ ਤਾਂ ਰੋਈ ਜਾਂਦਾ ਪਿਆ ਹੈਗਾ ਕੀ ਕਰੀਏ ਹੁਣ ਤੁਸੀਂ ਦੱਸੋ

ਹਾਂਜੀ ਮੈਡਮ ਇਹ ਨਾ ਇਹ ਠੰਡ ਬੜੀ ਠੰਡ ਬੜੀ ਹੈਗੀ ਕੀ ਕਰੀਏ ਹੁਣ ਬੱਚੇ ਦਾ ਸਕੂਲ ਆਉਣ ਨੂੰ ਦਿਲ ਵੀ ਨਹੀਂ ਕਰਦਾ ਹੈਗਾ

ਹਾਂਜੀ ਮੈਂ ਮੈਡਮ ਹੁਣ ਤੁਹਾਨੂੰ ਪਤਾ ਮੌਸਮ ਕਿੰਨਾ ਖ਼ਰਾਬ ਹੈ ਬੱਚੇ ਦਾ ਉੱਠਣ ਦਾ ਦਿਲ ਵੀ ਨਹੀਂ ਕਰਦਾ ਹੈਗਾ ਫਿਰ ਮੇਰਾ ਉਹਨੂੰ ਕਹਿੰਦੀ ਚਲ ਕੋਈ ਗੱਲ ਨਹੀਂ ਛੁੱਟੀਆਂ ਵੀ ਹੋਣ ਵਾਲੀਆਂ ਤੈਨੂੰ ਤੂੰ ਛੁੱਟੀ ਕਰ ਲਾ ਫਿਰ ਹਾਂ ਹੈਲੋ ਠੀਕ ਹੈ ਮੈਡਮ ਜੀ ਮੈਂ ਤੁਹਾਡੀ ਗੱਲ ਗੱਲ ਨੂੰ ਧਿਆਨ ਅਤੇ ਦਿੱਤਾ ਮੈਨੂੰ ਜ਼ੋਰ ਦੇਵਾਂਗੀ ਠੀਕ ਹੈ ਮੈਡਮ ਜੀ ਓਕੇ ਓਕੇ ਜੀ ਬਾਏ ਬਾਏ